ਮੈਨੂੰ ਆਪਣੇ ਬਾਰੇ ਦੱਸੋ

ਬਾਜ਼ਾਰ ਤੋਂ ਸ਼ੋਪਿੰਗ ਕਰਨੀ ਸਮਾਨ ਖਰੀਦਣਾ ਸਾਰਾ ਕੁਝ ਖੁਦ ਅਸੀਂ ਆਪ ਕਰਦੇ ਸੀ ਹਸਬੈਂਡ ਮੇਰੇ ਬਾਹਰ ਹੀ ਹੁੰਦੇ ਸੀ ਅਤੇ ਉਸ ਤੋਂ ਬਾਅਦ ਰਿਟਾਇਰਮੈਂਟ ਹੋ ਗਈ ਹੁਣ ਹੁਣ ਅਸੀਂ ਆਪਣੇ ਘਰ 'ਚ ਰਹਿ ਰਹੇ ਹਾਂ ਦੋਨੋਂ ਇਕੱਠੇ ਰਹਿ ਰਹੇ ਹਾਂ ਬੱਚੇ ਵੀ ਮੇਰੇ ਪਾਸ ਨੇ ਮੇਰੀਆਂ ਦੋ ਬੇਟੇ ਨੇ ਦੋਨੇਂ ਬਹੂਆਂ ਨੇ ਉਹ ਵੀ ਮੇਰੇ ਸਾਥ ਹੀ ਰਹਿ ਰਹੇ ਆ ਮੇਰੇ ਪਾਸ ਅਤੇ ਅਸੀਂ ਇਕੱਠਾ ਪਰਿਵਾਰ ਜੁਆਇੰਟ ਫੈਮਲੀ ਰਹਿ ਰਹੀ ਹੈ ਅਤੇ ਖੁਸ਼ ਹਾਂ ਅਸੀਂ ਇਸ ਟਾਇਮ ਮੇਰੀ ਉਮਰ ਸਿਕਸਟੀ ਸੈਵਨ ਹੋਈ ਹੋਈ ਹੈ ਅਤੇ ਮੇਰੇ ਹਸਬੈਂਡ ਦੀ ਉਮਰ ਸ ਉਨਾ ਸ਼ ਸੱਤ ਨੌਂ ਉਣਾਸੀ ਸਾਲ ਹੋਈ ਹੋਈ ਹੈ ਸ ਉਣੱਤਰ ਸਾਲ ਹੋਈ ਹੈ ਸਿਕਸ ਨਾਈਨ ਮੇਤੇ ਗਲਤ ਹੋ ਗਿਆ ਹ